ਸਤਿ ਸ਼੍ਰੀ ਅਕਾਲ ਪੰਜਾਬ ਵਿੱਚ ਬਹੁਤ ਸਾਰੇ ਸੈਲਾਨੀ ਆਕਰਸ਼ਣ ਹਨ ਜਿਵੇਂ ਕਿ ਜਲਿਆਂ ਵਾਲਾ ਬਾਗ਼ ਹਰਿਮੰਦਰ ਸਾਹਿਬ ਅਲਾਂਟੇ ਮਾਲ ਮੋਤੀ ਮਹਿਲ ਕਾਲੀ ਦੇਵੀ ਟੈਂਪਲ ਫਿਰ ਸ਼ੀਸ਼ ਮਹਿਲ ਰੋਕ ਗਾਰਡਨ ਬਹੁਤ ਸਾਰੇ ਹਨ ਪਰ ਸਭ ਤੋਂ ਜ਼ਿਆਦਾ ਜਿਹੜਾ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਆ ਉਹ ਆ ਆਪਣਾ ਗੋਲਡਨ ਟੈਂਪਲ ਜਿਹਨੂੰ ਕਿ ਅਸੀਂ ਜਿਹਨੂੰ ਕਿ ਅਸੀਂ ਹਰਿਮੰਦਰ ਸਾਹਿਬ ਕਹਿੰਦੇ ਹਾਂ ਜੋ ਅੰਮ੍ਰਿਤਸਰ ਵਿੱਚ ਸਥਿਤ ਆ ਅਤੇ ਉੱਥੇ ਬਹੁਤ ਸਾਰੇ ਦੇਸ਼ੀ ਵਿਦੇਸ਼ੀ ਸੈਲਾਨੀ ਆਉਂਦੇ ਆ ਦੋ ਬਹੁਤ ਸਾਰੇ ਦੇਸ਼ੀ ਵਿਦੇਸ਼ੀ ਟੂਰਿਸਟ ਉੱਥੇ ਆਉਂਦੇ ਆ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਾਂਤ ਜਗ੍ਹਾ ਆ ਤਾਂ ਵਿਦੇਸ਼ੀ ਜਿਹੜਾ ਕੋਈ ਵੀ ਬਾਹਰੋਂ ਆਉਂਦਾ ਆ ਪੰਜਾਬ ਵਿੱਚ ਤਾਂ ਉਹ ਜ਼ਰੂਰ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਾਂਦਾ ਆ ਓਥੇ ਬਾਬਾ ਜੀ ਦੇ ਦਰਸ਼ਨ ਕਰਦੇ ਆ ਲੰਗਰ ਛੱਕਦੇ ਆ ਫੇਰ ਉਸ ਤੋਂ ਬਾਅਦ ਨਾਲ ਹੀ ਜਲਿਆਂ ਵਾਲਾ ਬਾਗ਼ ਹੈਗਾ ਆ ਓਥੇ ਮਿਊਜ਼ੀਅਮ ਦੇਖਦੇ ਆ ਜਲਿਆਂ ਵਾਲਾ ਬਾਗ਼ ਦੇਖਦੇ ਆ ਉਹਦੇ ਵਿੱਚ ਜੋ ਵੀ ਘਟਨਾ ਹੋਈ ਸੀਗੀ ਉਹਦੇ ਦੋਰਾ ਉਹਦੇ ਉਹਦੇ ਉਹਦੇ ਹਿਸਾਬ ਨਾਲ ਜੋ ਵੀ ਦ੍ਰਿਸ਼ ਓਥੇ ਲਗਾਏ ਗਏ ਆ ਉਹ ਵੇਖਦੇ ਆ ਓਥੇ ਫ਼ੋਟੋਆਂ ਕਰਾਉਂਦੇ ਆ ਉਸ ਤੋਂ ਇਲਾਵਾ ਲੋਕ ਜਾਣਾ ਸ਼ੀਸ਼ ਮਹਿਲ ਜਾਣਾ ਬਹੁਤ ਪਸੰਦ ਕਰਦੇ ਆ ਕਾਲੀ ਦੇਵੀ ਮੰਦਰ ਜਾਣਾ ਬਹੁਤ ਪਸੰਦ ਕਰਦੇ ਆ ਫਿਰ ਚੰਡੀਗੜ੍ਹ ਵਿੱਚ ਰੋਕ ਗਾਰਡਨ ਆ ਓਥੇ ਜਾਣਾ ਬਹੁ ਪਸੰਦ ਕਰਦੇ ਆ ਅਤੇ ਗਰਮੀਆਂ ਵਿੱਚ ਜਦੋਂ ਛੁੱਟੀਆਂ ਹੁੰਦੀਆਂ ਆ ਅਤੇ ਉਦੋਂ ਲੋਕ ਫਨ ਸਿਟੀ ਆਪਣੇ ਹਾਰਡਇਜ ਵਰਡ ਜਿਹੜਾ ਆ ਆਪਣੇ ਲੁਧਿਆਣੇ ਵਿੱਚ ਹੈਗਾ ਆ ਓਥੇ ਜਾਣਾ ਬਹੁਤ ਪਸੰਦ ਕਰਦੇ ਆ ਫਿਰ ਉਸ ਤੋਂ ਇਲਾਵਾ ਲੋਕ ਆਪਣੇ ਸਾਇੰਸ ਸਿਟੀ ਵੀ ਜਾਂਦੇ ਆ ਜਿਹੜਾ ਆਪਣੇ ਜਲੰਧਰ ਵਿੱਚ ਸਥਿਤ ਆ ਬਹੁਤ ਸਾਰੇ ਸਕੂਲ ਦੇ ਜਿਹੜੇ ਬਹੁਤ ਸਾਰੇ ਸਕੂਲ ਦੇ ਜਿਹੜੇ ਟਰਿੱਪ ਜਾਂਦੇ ਆ ਬੱਚਿਆਂ ਨੂੰ ਸਕੂਲ ਵਾਲੇ ਲੈ ਕੇ ਜਾਂਦੇ ਆ ਉਹ ਜ਼ਿਆਦਾਤਰ ਸਾਇੰਸ ਸਿਟੀ ਹੀ ਲੈ ਕੇ ਜਾਂਦੇ ਆ ਕਿਉਂਕਿ ਸਾਇੰਸ ਸਿਟੀ ਬਹੁਤ ਸਾਰੇ ਸਾਇੰਸ ਦੇ ਰਿਲੇਟਡ ਚੀਜ਼ਾਂ ਹੈਗੀਆਂ ਆ ਉਹ ਬੱਚੇ ਦੇਖਦੇ ਆ ਓਹਦੇ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਆ ਓਥੇ ਜਾਣਾ ਬਹੁਤ ਪਸੰਦ ਕਰਦੇ ਅਤੇ ਉਸ ਤੋਂ ਇਲਾਵਾ ਵੰਡਰਲੈਂਡ ਜਿਹੜਾ ਸਭ ਦਾ ਫੇਵਰਟ ਆ ਉਹਦੇ 'ਤੇ ਤਾਂ ਪੰਜਾਬੀ ਗਾਣਾ ਵੀ ਬਣਿਆ ਹੋਇਆ ਆ ਅਤੇ ਉੱਥੇ ਵੀ ਜਾਣਾ ਲੋਕ ਬਹੁਤ ਪਸੰਦ ਕਰਦੇ ਆ ਅਤੇ ਪੰਜਾਬ ਵਿੱਚ ਤਾਂ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਘੁੰਮਣ ਵਾਲੀਆਂ ਅਤੇ ਸੈਲਾਨੀਆਂ ਲਈ ਪੰਜਾਬ ਇੱਕ ਬਹੁਤ ਵਧੀਆ ਜਗ੍ਹਾ ਆ ਕਿ ਇੱਥੇ ਆ ਸਕਦੇ ਆ ਅਤੇ ਬਹੁਤ ਸਾਰੀਆਂ ਜਗ੍ਹਾ 'ਤੇ ਘੁੰਮ ਸਕਦੇ ਆ